ਵੈਸੇ ਤਾਂ ਮੈਂ ਅੱਜ ਤੱਕ ਕੋਈ ਵੀ ਕੁਕਿੰਗ ਕਲਾਸ ਜੁਆਇੰਨ ਨਹੀਂ ਕੀਤੀ ਮੈਨੂੰ ਮੇਰੇ ਮਾਤਾ ਜੀ ਨੇ ਹੀ ਕੁਕਿੰਗ ਕਰਨੀ ਸਿਖਾਈ ਹੈ ਪਰ ਮੇਰੇ ਕੁਝ ਸਹੇਲੀਆਂ ਕੁਕਿੰਗ ਕਲਾਸ ਜਾਂਦੀਆਂ ਹਨ ਉਹਨਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਇੱਕ ਹਫਤਾ ਸਿਰਫ ਸਬਜ਼ੀਆਂ ਕੱਟਣਾ ਸਿਖਾਉਂਦੇ ਹਨ ਅਤੇ ਉਸ ਤੋਂ ਬਾਅਦ ਜਾ ਕੇ ਪ੍ਰੋਫੈਸ਼ਨਲ ਕੁਕਿੰਗ ਦੇ ਬਾਰੇ ਦੱਸਦੇ ਹਨ ਜੇਕਰ ਮੈਨੂੰ ਇਨ ਫਿਊਚਰ ਕੁਕਿੰਗ ਕਲਾਸ ਜੁਆਇੰਨ ਕਰਨਾ ਚਾਹਿਆ ਮੈਂ ਆਪਣੇ ਪ੍ਰੋਫੈਸ਼ਨ ਤੋਂ ਬਾਹਰ ਜਿਵੇਂ ਕਿ ਇਟੈਲੀਅਨ ਮੈਕਸੀਕਨ ਜੈਪਨੀਜ਼ ਚਾਈਨੀਸ ਫੂਡ ਬਣਾਉਣਾ ਸਿਖੂੰਗੀ ਕਿਉਂਕਿ ਮੈਨੂੰ ਮੇਰਾ ਭਾਰਤ ਦਾ ਪੰਜਾਬ ਦਾ ਭੋਜਨ ਬਣਾਉਣਾ ਆਉਂਦਾ ਹੈ ਮੈਂ ਮੇਰੀ ਦੂਸਰੇ ਭੋਜਨ ਬਣਾਉਣ ਵਿੱਚ ਰੁਚੀ ਹੈ ਅਤੇ ਇਸ ਕਰਕੇ ਮੈਂ ਆਹਾ ਚੀਜ਼ਾਂ ਸਿੱਖਣਾ ਚਾਹੂੰਗੀ